ਆਪਣੀ ਰਸੋਈ 'ਚ ਕਈ ਪ੍ਰਕਾਰ ਦੇ ਬਰਤਨ ਹੁੰਦੇ ਹਨ ਜਿਸ ਤਰ੍ਹਾਂ ਕਿ ਕੁੱਕਰ ਜਿਸ ਵਿੱਚ ਆਪਾਂ ਸਬਜ਼ੀ ਬਣਾਉਂਦੇ ਹਾਂ ਔਰ ਕੜਾਹੀ ਜਿਸ ਵਿੱਚ ਪੂਰੀ ਕਚੌਰੀ ਔਰ ਔਰ ਚੀਜ਼ਾਂ ਤਲ਼ੀਆਂ ਜਾਂਦੀਆਂ ਹਨ ਉਸ ਤੋਂ ਇਲਾਵਾ ਕੌਲੀ ਗਿਲਾਸ ਜਿਸ ਤਰ੍ਹਾਂ ਗਿਲਾਸ ਪਾਣੀ ਪੀਣ ਦੇ ਵਾਸਤੇ ਯੂਜ਼ ਆਉਂਦਾ ਹੈ ਔਰ ਕੌਲੀ ਸਬਜ਼ੀ ਵਗੈਰਾ ਚੱਮਚ ਪਲੇਟ ਰੋਟੀ ਵਾਸਤੇ ਯੂਜ਼ 'ਚ ਆਉਂਦੀ ਹੈ ਔਰ ਇੱਕ ਚਾਹ ਵਾਲਾ ਫਰਾਈ ਪੈਨ ਜਿਹਦੇ ਵਿੱਚ ਆਪਾਂ ਚਾਹ ਬਣਾਉਂਦੇ ਹਾਂ ਉਸ ਤੋਂ ਇਲਾਵਾ ਮਿਕਸੀ ਹੁੰਦੀ ਹੈ ਜਿਸ ਵਿੱਚ ਆਪਾਂ ਮਸਾਲਾ ਪੀਸਦੇ ਹਾਂ ਔਰ ਮਾਈਕ੍ਰੋ ਵਗੈਰਾ ਜਿਸ ਵਿੱਚ ਆਪਾਂ ਕੁਕਿੰਗ ਕਰਦੇ ਹਾਂ ਗੈਸ ਜਿਸ ਦੇ ਉੱਪਰ ਸਾਰਾ ਕੰਮ ਕਰਿਆ ਜਾਂਦਾ ਹੈ ਔਰ ਉਸ ਤੋਂ ਇਲਾਵਾ ਹੋਰ ਬਰਤਨ ਜਿਸ ਤਰ੍ਹਾਂ ਕੜਛੀਆਂ ਲਗਾ ਲਉ ਚਿਮਟਾ ਲਗਾ ਲਉ ਔਰ ਤਲ਼ਣੇ ਵਾਲੀ ਪੂਰੀਆਂ ਤਲ਼ਣੇ ਵਾਲੀ ਹੋ ਗਈ ਇਸ ਤਰ੍ਹਾਂ ਪੂਰੀਆਂ ਵਾਲੀ ਮਸ਼ੀਨ ਵੀ ਹੁੰਦੀ ਹੈ ਜਿਸ ਤਰ੍ਹਾਂ ਜਿਹਦੇ ਵਿੱਚ ਪੂਰੀਆਂ ਵੇਲੀਆਂ ਜਾਂਦੀਆਂ ਹੈ ਚੱਕਲਾ ਵੇਲਣਾ ਇਹ ਸਭ ਕੁਝ ਆਪਣੇ ਕਿਚਨ ਵਿੱਚ ਵਰਤਿਆ ਜਾਂਦਾ ਏ ਜੋ ਡੇਲੀ ਯੂਜ਼ 'ਚ ਆਪਣੇ ਯੂਜ਼ 'ਚ ਆਉਂਦਾ ਹੈ ਸਾਰਾ ਸਮਾਨ ਔਰ ਇਸ ਨੂੰ ਆਪਾਂ ਡੇਲੀ ਵਰਤਦੇ ਹਾਂ